ਪੰਜਾਬ ਵਿੱਚ ਪ੍ਰਮੁੱਖ ਸੈਟ ਅਸਾਈਡ ਪਾਰਟੀਆਂ ਅਤੇ ਨੇਤਾ ਦੀ ਸਥਿਤੀ ਕਾਫੀ ਵੱਖਰੀ ਹੈ ਪਰ ਮੁੱਖ ਸੈਟ ਅਸਾਈਡ ਪਾਰਟੀਆਂ ਉਹ ਹਨ ਜੋ ਸਿੱਖ ਧਰਮ ਜਾਂ ਪੰਜਾਬੀ ਸੰਸਕ੍ਰਿਤੀ ਨੂੰ ਪ੍ਰਧਾਨਤਾ ਦਿੰਦੀਆਂ ਹਨ ਅਤੇ ਹਿੱਤਾਂ ਦੀ ਸੁਰੱਖਿਆ ਲਈ ਕ੍ਰਿਆਸ਼ਾਲੀ ਹਨ ਇਹ ਪਾਰਟੀਆਂ ਮੁੱਖ ਤੌਰ 'ਤੇ ਸਥਾਨਕ ਅਤੇ ਖੇਤਰੀ ਮਸਲਿਆਂ 'ਤੇ ਧਿਆਨ ਦਿੰਦੀਆਂ ਹਨ ਜਿਵੇਂ ਕਿ ਖੇਤੀਬਾੜੀ ਸਿੱਖ ਧਰਮ ਦੇ ਮਸਲੇ ਅਤੇ ਪੰਜਾਬ ਦੀ ਪਰੰਪਾਰਿਕ ਸੰਸਕ੍ਰਿਤੀ ਦੀ ਸੁਰੱਖਿਆ ਦੂਜੇ ਪਾਸੇ ਮੇਟਾ ਇੱਕ ਨਵੀਂ ਅਤੇ ਤੇਜ਼ੀ ਨਾਲ ਵੱਧਦੀ ਟੈਕਨੋਲਜੀ ਕੰਪਨੀ ਹੈ ਜੋ ਡਿਜੀਟਲ ਮੀਡੀਆ ਅਤੇ ਟੈਕਨੋਲਜੀ ਖੇਤਰਾਂ ਵਿੱਚ ਕੰਮ ਕਰਦੀ ਹੈ ਮੇ ਮੇਟਾ ਦੀਆਂ ਪ੍ਰਫਾਇਲ ਪਲੇਟਫਾਰਮਾਂ ਨੂੰ ਸਿਆਸੀ ਅਤੇ ਸਮਾਜਿਕ ਸੰਗਰਾਵਾਂ ਵਿੱਚ ਭੂਮੀਕਾ ਦੇਣ ਵਾਲੀ ਸਮਗਰੀਆਂ ਲਈ ਜਾਣਿਆ ਜਾਂਦਾ ਹੈ ਇਸ ਨਾਲ ਲੋਕਾਂ ਦੀ ਸੋਚ ਅਤੇ ਵਿਭਿੰਨ ਰਾਏ ਸਿੱਧ ਕਰਨ ਵਿੱਚ ਸਹਾਇਤਾ ਮਿਲਦੀ ਹੈ ਇਸ ਤਰ੍ਹਾਂ ਜਿੱਥੇ ਪ੍ਰਮੁੱਖ ਸੈਟ ਅਸਾਈਡ ਸਾਈਡ ਪਾਰਟੀਆਂ ਸਥਾਨਕ ਅਤੇ ਧਾਰਮਿਕ ਮਸਲਿਆਂ 'ਤੇ ਧਿਆਨ ਕੇਂਦਰਿਤ ਕਰਦੀਆਂ ਹਨ ਉੱਥੇ ਵੱਡੀ ਡਿਜੀਟਲ ਹਾਰਮੋਨੀ ਵਧਾਉਣ ਵਾਲੀ ਏਜੰਸੀ ਬਣੀ ਹੋਇਆ ਜੋ ਕਿ ਸੋਸ਼ਲ ਮੀਡੀਆ ਦੀ ਦੁਨੀਆਂ 'ਚ ਮੌਜੂਦ ਹੈ